ਮੈਨੂੰ ਜਿਹੜਾ ਫ਼ੋਟੋਗ੍ਰਾਫ਼ੀ ਕਰਨ ਦਾ ਸ਼ੌਕ ਬਹੁਤ ਜ਼ਿਆਦਾ ਹੈ ਇਹ ਸ਼ੌਕ ਜਦੋਂ ਮੈਂ ਬੀ ਏ ਦੇ ਵਿੱਚ ਵੀਹ ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਫ਼ੋਨ ਲਿਆ ਸੀ ਉਸ ਟਾਈਮ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਸੀ ਮੈਂ ਮਤਲਬ ਕਿ ਬਹੁਤ ਜਗ੍ਹਾ ਜਗ੍ਹਾ 'ਤੇ ਜਾ ਕੇ ਜਿਹੜੀਆਂ ਆਪਣੀਆਂ ਫੋਟੋਜ਼ ਕਲਿੱਕ ਕਰਦੀ ਸੀ ਉਸ ਟਾਈਮ ਜਿਹੜਾ ਜ਼ਿਆਦਾ ਇੰਸਟਾਗ੍ਰਾਮ ਅਤੇ ਵਟਸਐੱਪ ਦਾ ਟਰੈਂਡ ਨਾ ਹੋਣ ਕਰਕੇ ਜਿਹੜੀਆਂ ਮੇਰੀਆਂ ਫੋਟੋ ਹੈ ਉਹ ਮਤਲਬ ਉਹਨੂੰ ਦੇਖਣ ਵਾਲੇ ਲੋਕ ਆ ਜਿਹੜੇ ਬਹੁਤ ਘੱਟ ਰਹਿ ਗਏ ਸੀ ਪਰ ਹੁਣ ਮੈਂ ਇੰਸਟਾਗ੍ਰਾਮ ਵਟਸਐੱਪ ਫੇਸਬੁੱਕ ਇਹਨਾਂ ਥਰੂ ਜਿਹੜੀਆਂ ਆਪਣੀਆਂ ਫੋਟੋਜ਼ ਅਪਲੋਡ ਕਰਦੀ ਹਾਂ ਤਾਂ ਮੇਰੇ ਜਿਹੜੇ ਦੋਸਤ ਮਿੱਤਰ ਹੈ ਮੈਨੂੰ ਉਹ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦੇ ਹੋ ਦਿੰਦੇ ਹੈ ਵੀ ਤੁਹਾਡੀਆਂ ਜਿਹੜੀਆਂ ਫੋਟੋਜ਼ ਬਹੁਤ ਸੋਹਣੀਆਂ ਮੈਂ ਫੋਟੋਜ਼ ਦੇ ਵਿੱਚ ਕੁਦਰਤੀ ਦ੍ਰਿਸ਼ ਹੈ ਜਿਹੜੇ ਉਹਨਾਂ ਨੂੰ ਕੈਦ ਕਰਦੀ ਹਾਂ ਮੇਰੀਆਂ ਫੋਟੋਜ਼ ਮੈਨੂੰ ਰੈਂਡਮ ਫੋਟੋਜ਼ ਜਿਹੜੀਆਂ ਖਿੱਚਣ ਦਾ ਬਹੁਤ ਜ਼ਿਆਦਾ ਸ਼ੌਕ ਹੈ ਅਤੇ ਜਿਹੜੇ ਮੇਰੇ ਹੁਣ ਫੋਲੋਅਰਸ ਬਹੁਤ ਜ਼ਿਆਦਾ ਵੱਧ ਰਹੇ ਹਨ ਜਿਹੜੇ ਮੈਨੂੰ ਇਹ ਕਹਿੰਦੇ ਆ ਕਿ ਤੁਸੀਂ ਆਪਣਾ ਇਹ ਸ਼ੌਕ ਜਿਹੜਾ ਇਹਨੂੰ ਕਦੇ ਵੀ ਡਾਊਨ ਨਹੀਂ ਜਾਣ ਦੇਣਾ ਉਹ ਮੈਨੂੰ ਮੋਟੀਵੇਸ਼ਨ ਇੰਨੀ ਦਿੰਦੇ ਹੈ ਮੇਰਾ ਜਿਹੜਾ ਫ਼ੋਟੋਗ੍ਰਾਫ਼ੀ ਹੈ ਮੇਰਾ ਸ਼ੌਕ ਦਿਨ ਬ ਦਿਨ ਜਿਹੜਾ ਵੱਧ ਰਿਹਾ